ਗਲੇ ਨੂੰ ਠੀਕ ਕਰਨ ਲਈ ਪ੍ਰਸਿੱਧ ਘਰੇਲੂ ਨੁਕਸੇ ਹਨ ਸ਼ਹਿਦ ਅਤੇ ਕਾਲੀ ਮਿਰਚ ਨੂੰ ਮਿਕਸ ਕਰਕੇ ਛੋਟਿਆਂ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਜੇਕਰ ਉਸ ਤੋਂ ਠੀਕ ਨਾ ਹੋਵੇ ਤਾਂ ਹਲਕੇ ਗਰਮ ਪਾਣੀ ਅਤੇ ਨਮਕ ਨੂੰ ਮਿਕਸ ਕਰਕੇ ਗਲੇ ਨੂੰ ਗਰਾਰੇ ਕਰਨ ਲਈ ਕਿਹ ਕਿਹਾ ਜਾਂਦਾ ਹੈ ਅਤੇ ਇਸ ਸਮੇਂ ਕਈ ਦਵਾਈਆਂ ਬਣ ਚੁੱਕੀਆਂ ਹਨ ਪਰ ਫਿਰ ਵੀ ਲੋਕ ਪਰ ਫਿਰ ਵੀ ਪੁਰਾਣੇ ਪਿੰਡਾਂ ਦੇ ਲੋਕ ਪੁਰਾਣੇ ਘਰੇਲੂ ਨੁਸਖੇ ਹੀ ਅਜ਼ਮਾਉਂਦੇ ਹਨ ਕਈ ਕਈ ਪਿੰਡਾਂ 'ਚ ਦਵਾਈਆਂ ਡਾਕਟਰ ਪਹੁੰਚਾ ਦਿੰਦੇ ਹਨ ਪਰ ਅਸਰ ਨਾ ਹੋਣ ਕਰਕੇ ਗਰੇ ਪਿੰਡਾਂ ਦੇ ਗਰੇਲੀ ਪਿੰਡਾਂ ਦੇ ਵੈਦ ਵੈਦਿਕ ਹੀ ਉਹਨਾਂ ਦਾ ਗਲਾ ਠੀਕ ਕਰ ਦਿੰਦੇ ਹਨ ਅਤੇ ਉਹਨਾਂ ਦਾ ਗਲਾ ਇਸ ਤੋਂ ਦਵਾਈਆਂ ਦਾ ਅੱਛਾ ਅਸਰ ਪੈਂਦਾ ਹੈ ਦਵਾਈ ਤੋਂ ਅੱਛਾ ਅਸਰ ਪੈਂਦਾ ਹੈ ਉਸ ਵੈਦਿਕ ਦੇ ਕਾਮ 'ਚ